ਸਾਡੇ ਪਹਿਲਾਂ ਲੱਕੜ ਚੁੱਲ੍ਹੇ ਦੀ ਵਰਤੋਂ ਕੀਤੀ ਸਨ ਜਾਂਦੀ ਸੀ ਉਸ ਵਿੱਚ ਲੱਕੜਾਂ ਲਗਾਈਆਂ ਜਾਂਦੀਆਂ ਸੀ ਜਿਸ ਨਾਲ ਬਹੁਤ ਹੀ ਧੂਆਂ ਹੁੰਦਾ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਜਦੋਂ ਦਾ ਅਸੀਂ ਗੈਸ ਸਿਲੰਡਰ ਦੀ ਵਰਤੋਂ ਕਰਨ ਲੱਗੇ ਹਾਂ ਤਾਂ ਉਸ ਨਾਲ ਧੂਆਂ ਅਤੇ ਗੈਸਾਂ ਘੱਟ ਫੈਲਦੀਆਂ ਹਨ ਅਤੇ ਇਸ ਦਾ ਇੱਕ ਨੁਕਸਾਨ ਹੈ ਕਿ ਇਸਦਾ ਫੱਟਣ ਦਾ ਖਤਰਾ ਰਹਿੰਦਾ ਹੈ ਅਤੇ ਇਸ ਦੀਆਂ ਕੀਮਤਾਂ ਵੀ ਵੱਧ ਹਨ